ਹਾਂ ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਹਨ ਇਹਨਾਂ ਦਾ ਮੇਨ ਮਕਸਦ ਹੁੰਦਾ ਹੈ ਕਿ ਜਿਹੜੇ ਅੱਜ ਦੇ ਨੌਜਵਾਨ ਬੱਚੇ ਹਨ ਉਹਨਾਂ ਦੀ ਸਿਹਤ ਵਧੀਆ ਬਣਾਈ ਜਾ ਸਕੇ ਅਤੇ ਜੋ ਨੌਜਵਾਨ ਨਸ਼ਿਆਂ ਦੀ ਜਕੜ ਵਿੱਚ ਆ ਗਏ ਹਨ ਉਹਨਾਂ ਦਾ ਧਿਆਨ ਖੇਡਾਂ ਵੱਲ ਕੇਂਦਰਿਤ ਕਰਨ ਲਈ ਸਾਡੇ ਖੇਤਰ ਸਾਡੇ ਖੇਤਰ ਦੇ ਐੱਮ ਐੱਲ ਏ ਬਹੁਤ ਸਾਰੀਆਂ ਖੇਡਾਂ ਦਾ ਪ੍ਰੋਗਰਾਮ ਕਰਦੇ ਹਨ ਇਹਨਾਂ ਨਾਲ਼ ਬੱਚਿਆਂ ਦੀ ਸਿਹਤ ਵਧੀਆ ਰਹਿੰਦੀ ਹੈ ਮੈਂ ਵੀ ਮੈਂ ਵੀ ਮੈਂ ਵੀ ਖੇਡਾਂ ਵਿੱਚ ਹਿੱਸਾ ਲੈਂਦੀ ਹਾਂ ਇਸ ਨਾਲ਼ ਮੇਰੀ ਸਿਹਤ 'ਤੇ ਵਧੀਆ ਪ੍ਰਭਾਵ ਪੈਂਦਾ ਹੈ ਅਤੇ ਮੈਂ ਸਵੇਰੇ ਜਲਦੀ ਉੱਠ ਕੇ ਭੱਜਣ ਜਾਂਦੀ ਹਾਂ